ਪੰਜਾਬ ਵਿੱਚ ਸਰਕਾਰ ਨੇ ਸਿਹਤ ਸੰਬੰਧੀ ਕਈ ਸਹੂਲਤਾਂ ਹਸਪਤਾਲ ਅੰਦਰ ਦਿੱਤੀਆਂ ਹਨ ਜਿੱਥੇ ਕਿ ਲੋਕ ਸਰਕਾਰੀ ਹਸਪਤਾਲ ਵਿੱਚ ਜਾਂਦੇ ਹਨ ਅਤੇ ਲੋਕ ਪਿੰਡਾਂ ਤੋਂ ਵੀ ਇਹਨਾਂ ਸਹੂਲਤਾਂ ਦਾ ਫਾਇਦਾ ਉਠਾਉਂਦੇ ਹਨ ਅਤੇ ਕੁਛ ਬਜ਼ੁਰਗ ਲੋਕ ਹੁੰਦੇ ਹਨ ਜੋ ਕਿ ਇਹਨਾਂ ਵਿੱਚ ਸੱਤਰ ਸਾਲ ਦੇ ਬਜ਼ੁਰਗ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਅਤੇ ਸਰਕਾਰ ਨੇ ਪੰਜ ਲੱਖ ਵਾਲੀ ਯੋਜਨਾ ਅਧੀਨ ਆਪਰੇਸ਼ਨ ਜਾਂ ਐਕਸੀਡੈਂਟ ਕੇਸ ਵਿੱਚ ਵੀ ਸਹੂਲਤ ਵੀ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਸਾਨੂੰ ਉੱਥੇ ਦਸ ਰੁਪਏ ਦੀ ਪਰਚੀ ਕਟਵਾਉਣੀ ਪੈਂਦੀ ਹੈ ਫਰੀ ਦਵਾਈ ਮਿਲ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਗਰੀਬ ਲੋਕ ਜੋ ਕਿ ਪੈਸਾ ਨਹੀਂ ਖਰਚ ਸਕਦੇ ਉਹ ਸਰਕਾਰੀ ਸਹੂਲਤਾਂ ਲੈ ਕੇ ਉੱਥੋਂ ਠੀਕ ਹੁੰਦੇ ਹਨ ਅਤੇ ਜੋ ਨਰਸਾਂ ਹੋਸਪੀਟਲ ਵਿੱਚ ਲੱਗੀਆਂ ਹੋਈਆਂ ਹੁੰਦੀਆਂ ਹਨ ਉਹਨਾਂ ਪਿੰਡਾਂ ਵਿੱਚ ਜਾ ਕੇ ਸਰਕਾਰੀ ਕੈਂਪ ਲਗਾ ਕੇ ਅਤੇ ਮੁਫਤ ਇਲਾਜ ਕਰਦੀਆਂ ਹਨ ਇਸ ਲਈ ਸਾਨੂੰ ਕਈ ਸਹੂਲਤਾਂ ਦੀ ਪ੍ਰਾਪਤੀ ਹੁੰਦੀ ਹੈ ਧੰਨਵਾਦ